ਹੈਲੋ ਮੈਂ ਸਿਮਰਪ੍ਰੀਤ ਸਿੰਘ ਹਾਂ ਮੈਂ ਹਾਲ ਹੀ ਵਿੱਚ ਆਪਣੇ ਦੋਸਤ ਨੂੰ ਉਸਦੇ ਬਰਡੇ ਉੱਤੇ ਆਪਣੇ ਹੱਥਾਂ ਨਾਲ਼ ਬਣੀ ਹੋਈ ਪੇਂਟਿੰਗ ਦਾ ਤੋਹਫ਼ਾ ਦਿੱਤਾ ਹੈ ਮੈਂ ਪੇਂਟਿੰਗ ਬਣਾਉਣ ਵਿੱਚ ਕਾਫ਼ੀ ਜ਼ਿਆਦਾ ਮਿਹਨਤ ਅਤੇ ਪਿਆਰ ਨਾਲ਼ ਪੇਂਟਿੰਗ ਬਣਾਈ ਹੈ ਇਸ ਵਿੱਚ ਮੈਂ ਕਾਫ਼ੀ ਤਰ੍ਹਾਂ ਦੇ ਰੰਗ ਭਰੇ ਹਨ ਹੱਥ ਨਾਲ਼ ਬਣੀ ਹੋਈ ਪੇਂਟਿੰਗ ਦਾ ਜ਼ਿਆਦਾ ਭਾਵਨਾਤਮਕ ਮੁੱਲ ਇਸ ਲਈ ਹੁੰਦਾ ਹੈ ਕਿਉਂਕਿ ਉਸ ਵਿੱਚ ਆਪਾਂ ਬੰਦੇ ਲਈ ਅਗਲੇ ਬੰਦੇ ਲਈ ਆਪਣਾ ਪਿਆਰ ਅਤੇ ਭਾਵਨਾ ਪ੍ਰਗਟ ਕਰਦੇ ਹਾਂ ਜੋ ਕਿ ਅਗਲਾ ਬੰਦਾ ਸਮਝਦਾ ਹੈ ਕਿਉਂਕਿ ਅਜੇ ਤਕਨੀਕੀ ਯੁੱਗ ਵਿੱਚ ਜ਼ਿਆਦਾਤਰ ਮਸ਼ੀਨਾਂ ਨਾਲ਼ ਬਣਾਈ ਹੋਈ ਚੀਜ਼ਾਂ ਬਨਾਵਟੀ ਚੀਜ਼ਾਂ ਲੋਕ ਇੱਕ ਦੂਜੇ ਨੂੰ ਦਿੰਦੇ ਹਨ ਅੱਜ ਕੱਲ੍ਹ ਦੇ ਯੁੱਗ ਵਿੱਚ ਹੱਥਾਂ ਨਾਲ਼ ਬਣਾਈ ਹੋਈ ਚੀਜ਼ਾਂ ਜਾਂ ਹੱਥੀਂ ਲਿਖੀਆਂ ਹੋਈਆਂ ਕਾਰਡ ਬਣਾਏ ਹੋਏ ਪੇਂਟਿੰਗਾਂ ਬਹੁਤ ਹੀ ਘੱਟ ਦਿੰਦੇ ਹਨ ਤਾਂ ਕਰਕੇ ਇਹ ਅੱਜ ਦੇ ਤਕਨੀਕੀ ਯੁੱਗ ਵਿੱਚ ਹੱਥਾਂ ਨਾਲ ਬਣੀਆਂ ਹੋਈਆਂ ਚੀਜ਼ਾਂ ਬਹੁਤ ਹੀ ਮ ਮੁੱਲ ਰੱਖਦੀਆਂ ਹਨ ਹੱਥਾਂ ਨਾਲ਼ ਬਣੀਆਂ ਹੋਈਆਂ ਚੀਜ਼ਾਂ ਆਪਣੇ ਭਾਵ ਆਪਣਾ ਦੂਸਰੇ ਬੰਦੇ ਲਈ ਪਿਆਰ ਪ੍ਰਗਟ ਕਰਦੀਆਂ ਹਨ ਧੰਨਵਾਦ